ਹੈਲੋ ਹੈਲੋ ਗੁਡ ਆਫਟਰਨੂਨ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਬੋਲੋ ਅੱਛਾ ਜੀ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਮੈਮ ਬਹੁਤ ਸਾਰੀ ਐਕਟੀਵਿਟੀਜ ਹਨ ਬੱਚੇ ਕੋ ਆਪ ਚਾਹੇ ਐਰੋਬਿਕਸ ਕਰਵਾ ਦੋ ਚਾਹੇ ਉਸਨੇ ਗੇਮਸ ਮੇ ਡਿਸਕਸ ਥ੍ਰੋ ਹੈ ਅੱਛਾ ਬੈਡਮਿੰਟਨ ਖੇਲ ਲੇਗਾ ਬੈਡਮਿੰਟਨ ਹਾਂ ਉਹ ਕਰਵਾ ਦੋ ਜੁਆਇੰਨ ਅੱਜਕਲ ਬੱਚੇ ਉਹ ਇੰਟਰਸਟ ਬੇਸ ਤੇ ਖੇਲਤੇ ਉਸਮੇ ਪਹਿਲੇ ਹੈ ਨਾ ਪਹਿਲੇ ਬੱਚੇ ਕੋ ਵਰਕ ਆਊਟ ਕਰਵਾਤੇ ਠੀਕ ਐ ਵਰਕ ਆਊਟ ਕਰਕੇ ਫਿਰ ਬੱਚੇ ਕੋ ਮਤਲਵ ਆਧਾ ਘੰਟਾ ਵਰਕ ਆਊਟ ਕਰਵਾ ਕੇ ਉਸਕੇ ਬਾਅਦ ਹਮ ਬੈਡਮਿੰਟਨ ਕੇ ਲੀਏ ਤਿਆਰ ਕਰਤੇ ਹੈ ਬੱਚੋਂ ਕੋ ਉਸ ਸੇ ਫਿਟਮੈੱਨ ਵੀ ਹੋ ਜਾਤੀ ਹੈ ਔਰ ਬੱਚੋਂ ਕੀ ਜੋ ਵੇਟ ਹੋ ਰਹਾ ਆਜ ਕੱਲ ਕੰਮ ਏ ਤੇ ਈਸ਼ੂ ਹੈ ਬੱਚੋ ਕਾ ਬੈਠੇ ਬੈਠੇ ਮੋਬਾਇਲ ਦੇਖਤੇ ਰਹਿਤੇ ਹੈ ਹਾਂਜੀ ਮੈਂਮ ਆਫਟਰ ਹਮਨੇ ਨਾ ਬੱਚੋਂ ਕੇ ਟਾਈਮਿੰਗ ਕੀ ਸਕੂਲ ਟਾਈਮਿੰਗ ਕੇ ਬਾਅਦ ਉਸਕੇ ਬਾਅਦ ਟਿਊਸ਼ਨ ਹੋਤੀ ਉਸਕੇ ਅਕੋਡਿੰਗ ਹੀ ਹਮ ਕੰਸੀਡਰ ਕਰਕੇ ਹਮ ਨੇ ਨਾ ਸਿਕਸ ਟੂ ਏਟ ਰੱਖਾ ਹੂਆ ਹੈ ਟਾਈਮ ਸਿਕਸ ਟੂ ਏਟ ਸੈਵਨ ਟੂ ਨਾਈਨ ਹਾਂ ਹਾ ਠੀਕ ਸੈਵਨ ਟੂ ਨਾਇਨ ਹੈ ਹਾਂਜੀ ਹਾਂਜੀ ਠੀਕ ਹੈ ਫਿਫਟੀਨ ਹੰਡਰਡ ਪਰ ਮੰਨਥ ਐ ਮੈਮ ਪੰਦਰਾ ਸੋ ਰੁਪਏ ਪਰ ਮੰਨਥ ਐ ਹਨਾ ਇਸਕੇ ਲੀਏ ਆਪਕੋ ਨਾ ਬੱਚੇ ਕੋ ਸ਼ੂ ਲੈ ਕੇ ਦੇਨੇ ਪੜੇਗੇ ਹਨਾ ਤੋ ਸਪੈਸ਼ਲ ਉਸਕੇ ਲੀਏ ਬੈਡਮਿੰਟਨ ਗਰਾਊਂਡ ਮੇ ਜਾਨੇ ਕੇ ਲੀਏ ਏਕ ਰੈਕਿਟ ਸ਼ਟਰ ਲੈ ਕੇ ਆਨੀ ਐ ਔਰ ਸ਼ ਸ਼ੂ ਲੈ ਕੇ ਆਨੇ ਐ ਮੇਨ ਵੋ ਹੀ ਐ ਕਿਉਂਕੀ ਸ਼ੂ ਕੇ ਬਿਨਾਂ ਬੱਚੇ ਕੋ ਹਮ ਉਸਮੇ ਨੀ ਜਾਨੇ ਦੇਤੇ ਬੈਡਿੰਟਨ ਗਰਾਊਂਡ ਮੇ ਨਾ ਕਿਉਂਕੀ ਵੋਹ ਉਸਕੇ ਲੀਏ ਮੈਟ ਹੋਤੇ ਹੈ ਹਾਂ ਹਾਂ ਬਿਲਕੁਲ ਬਿਲਕੁਲ ਇਸ ਕੇ ਬਿਨਾ ਬੱਚੇ ਕੋ ਨੀ ਹਮ ਮਾਰਕੀਟ ਸੇ ਮਾਰਕੀਟ ਸੇ ਪਰਚੇਸ ਕਰਲੋ ਠੀਕ ਹੈ ਜੀ ਨਹੀਂ ਮੈਮ ਪਹਿਲੀ ਰੀਜਨੇਬਲ ਹੈ ਹਮੇ ਵੀ ਕੋਚ ਵਗੈਰਾ ਰੱਖਣੇ ਪੜਤੇ ਹੈ ਸਾਰੇ ਈ ਗਰਾਊਂਡ ਚੋ ਇਸਕੇ ਲੀਏ ਉਹ ਬਣਤਾ ਨਾ ਰੂਮ ਉਸਕੇ ਹੀ ਹਮਾਰੀ ਬਹੁਤ ਸਾਰੇ ਐਕਸਪੈਂਸਸ ਲੱਗ ਜਾਤੇ ਆ ਮੈਮ ਇਤਨੀ ਰਹੇਗੀ ਫੀਸ ਤੋ ਸਭੀ ਜਗਾ ਇਤਨੀ ਆ ਆਪ ਚਾਹੇ ਪੂਛ ਸਕਤੇ ਹੋ ਕਿਸੀ ਸੇ ਓਕੇ ਮੈਮ ਓਕੇ ਓਕੇ